ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਹਨ ਜਿਵੇਂ ਕਿ ਖੋ ਖੋ ਕਬੱਡੀ ਅਤੇ ਹੋਰ ਗੀਟੇ ਵਗੈਰਾ ਪੀਚੋ ਔਰ ਕੌਕਲਾ ਪਛਾਕੀ ਹੋਰ ਨਾ ਛੋਟੀਆਂ ਛੋਟੀਆਂ ਗੇਮਾਂ ਖੇਡੀਆਂ ਹਨ ਜਿਹਦੇ ਵਿੱਚ ਜਿਵੇਂ ਕਿ ਖੋ ਖੋ ਵਿੱਚ ਬਹੁਤ ਜ਼ਿਆਦਾ ਦੌੜਿਆ ਵੀ ਜਾਂਦਾ ਹੈ ਅਤੇ ਆਪਣਾ ਪਾੜੇ ਤੋਂ ਬਾਹਰ ਵੀ ਨਹੀਂ ਜਾਇਆ ਜਾਂਦਾ ਅਤੇ ਖੋ ਵੀ ਦਿੱਤੀ ਜਾਂਦੀ ਹੈ ਅਤੇ ਉਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਇਨਾਮ ਵੀ ਲਏ ਆਪਣੀ ਜ਼ਿੰਦਗੀ ਵਿੱਚ ਅਤੇ ਸਾਨੂੰ ਬਹੁਤ ਜ਼ਿਆਦਾ ਆਪਣੇ ਅਧਿਆਪਕਾਂ ਕੋਲ਼ੋ ਸਤਿਕਾਰ ਵੀ ਮਿਲਿਆ ਕਰਦਾ ਸੀ ਅਤੇ ਉਸ ਤੋਂ ਬਾਅਦ ਅਸੀਂ ਘਰ ਆਉਣਾ ਅਤੇ ਸਹੇਲੀਆਂ ਨਾਲ਼ ਗੀਟੇ ਵੀ ਖੇਡਣੇ ਉਹਦੇ ਵਿੱਚ ਅਸੀਂ ਪੰਜ ਗੀਟੇ ਲੈਂਦੀਆਂ ਸਨ ਉਹਦੇ ਵਿੱਚ ਅਸੀਂ ਜਿਨ੍ਹਾਂ ਨੇ ਜਿੱਤਣਾ ਅਤੇ ਉਹਨਾਂ ਨਾਲ਼ ਬਹੁਤ ਬੜਾ ਓ ਲਾਭ ਹੁੰਦਾ ਸੀ ਅਤੇ ਪੀਚੋ ਵੀ ਖੇਡੀ ਜਾਂਦੀ ਸੀ ਲੰਗੜੀ ਲੱਤ ਵੀ ਖੇਡਦੀਆਂ ਸੀ ਇੱਕ ਦੂਏ ਨੂੰ ਛੂਹਣ ਛਣਾਕਾ ਖੇਡਦੀਆਂ ਸੀ ਅਤੇ ਅਸੀਂ ਬਹੁਤ ਆਪਣੇ ਜ਼ਿੰਦਗੀ ਵਿੱਚ ਇੰਨਜੁਆਏ ਕਰਿਆ ਅਤੇ ਬਹੁਤ ਖੇਡਾਂ ਖੇਡੀਆਂ ਹਨ ਅਤੇ ਬਹੁਤ ਜ਼ਿਆਦਾ ਆਨੰਦ ਮਾਣਿਆ ਹੈ